ਦਸ ਜਨਵਰੀ ਦੋ ਹਜ਼ਾਰ ਦਸ ਇਕੱਤੀ ਅਗਸਤ ਦੋ ਹਜ਼ਾਰ ਪੰਜ ਇੱਕੀ ਜਨਵਰੀ ਦੋ ਹਜ਼ਾਰ ਬਾਰ੍ਹਾਂ ਸਤਾਰ੍ਹਾਂ ਅਗਸਤ ਦੋ ਹਜ਼ਾਰ ਤੇਈ ਅਤੇ ਇਕੱਤੀ ਜਨਵਰੀ ਦੋ ਹਜ਼ਾਰ ਤੇਈ